ਸਤਿ ਸ਼੍ਰੀ ਅਕਾਲ ਸਰ ਜੀ ਸ ਸਰ ਜੀ ਮੈਂ ਮਲਕੀ ਹਰ ਤਰ੍ਹਾਂ ਦੀ ਸਿਲਾਈ ਕਰ ਲੈਂਦੀ ਹਾਂ ਅਤੇ ਮੇਰੇ ਕੋਲ ਮਲਕੀ ਹਰ ਤਰ੍ਹਾਂ ਦੇ ਸੂਟ ਸੀਨੇ ਹਾਂ ਜਾਂਦੇ ਆ ਪਲਾਜੋ ਸੂਟ ਸਲਵਾਰ ਸੂਟ ਮਲਕੀ ਹਰ ਤਰ੍ਹਾਂ ਦੇ ਸੂਟ ਆਉਂਦੇ ਆ ਅਤੇ ਮੇਰੇ ਕੋਲ ਮਤਲਬ ਕਿ ਮੈਂ ਮੇਰਾ ਇੱਕ ਬੁਟੀਕ ਹੈ ਅਤੇ ਬੁਟੀਕ ਵਿੱਚ ਮਲਕੀ ਹਰ ਤਰ੍ਹਾਂ ਦੀ ਚੀਜ਼ ਹੈਗੀ ਹੈ ਮੇਰੇ ਕੋਲ ਰੀਲਾਂ ਦੇ ਡੱਬੇ ਬੁਕਰਮਾਂ ਸੂਈਆਂ ਗਲੇ ਸਭ ਕੁਸ਼ ਹੈਗਾ ਆ ਅਤੇ ਮਲਕੀ ਮੈਂ ਮਲਕੀ ਹਰ ਤਰ੍ਹਾਂ ਦੇ ਸੂਟ ਸੀ ਲੈਂਦੀ ਹਾਂ ਪਲਾਜੋ ਸੂਟ ਅਤੇ ਮੈਨੂੰ ਨਾ ਮਲਕੀ ਪੀਕੋ ਕਰਨ ਵਾਲੀ ਮਸ਼ੀਨ ਵੀ ਹੈਗੀ ਆ ਮਲਕੀ ਜਿਹੜੇ ਮਲਕੀ ਕਸਟਮਰ ਆਉਂਦੇ ਆ ਮੇਰੇ ਕੋਲ ਸੂਟ ਸਿਲਾਉਂਦੇ ਹਾਂ ਅਤੇ ਮੇਰੇ ਕੋਲ ਮਲਕੀ ਹਰ ਤਰ੍ਹਾਂ ਦੀ ਚੀਜ਼ ਹੈਗੀ ਹੈ ਮੈਨੂੰ ਮਲਕੀ ਇੱਕ ਮਲਕੀ ਇੱਕ ਚੀਜ਼ ਮੇਰੇ ਕੋਲ ਘੱਟ ਹੈ ਮਲਕੀ ਇੰਟਰਲੋਕ ਵਾਲੀ ਮਸ਼ੀਨ ਆ ਬਸ ਮੈਨੂੰ ਉਹਦੀ ਲੋੜ ਹੈ ਮਲਕੀ ਜਿਹੜੇ ਉੱਧਰੋਂ ਉੱਧਰੋਂ ਉੱਧਰੋਂ ਗਾਹਕ ਜਾਂਦੇ ਆ ਕਸਟਮਰ ਜਿਹੜੇ ਉੱਧਰ ਉੱਧਰ ਜਾਂਦੇ ਆ ਨਾ ਅਤੇ ਮੈਂ ਇੰਟਰਲਾਕ ਵਾਲੀ ਮਸ਼ੀਨ ਲੈ ਕੇ ਅਤੇ ਜਿਹੜੇ ਉੱਧਰ ਉੱਧਰ ਗਾਹਕ ਜਾਂਦੇ ਆ ਤਾਂ ਮੈਂ ਉਹ ਵੀ ਗਾਹਕ ਮਲਕੀ ਉੱਧਰ ਉੱਧਰ ਨਹੀਂ ਜਾਣਾ ਅਤੇ ਮੈਂ ਸੂਟ ਸੀ ਕਿ ਇੰਟਰਲੋਕ ਕਰਕੇ ਅਤੇ ਉਹਨਾਂ ਨੂੰ ਦੇ ਦਾ ਅਤੇ ਕੋਈ ਵੀ ਉੱਧਰ ਉੱਧਰ ਗਾਹਕ ਨਹੀਂ ਜਾਏ ਅਤੇ ਮਲਕੀ ਪੂਰਾ ਕੰਮ ਤਿਆਰ ਕਰ ਕੇ ਪੂਰਾ ਸੂਟ ਤਿਆਰ ਕਰ ਕੇ ਪੀਕੋ ਕਰ ਕੇ ਇੰਟਰਲੋਕ ਕਰ ਕੇ ਸੂਟ ਸਿਲਾਈ ਕਰ ਕੇ ਅਤੇ ਉਹਨਾਂ ਨੂੰ ਦੇ ਸਕਾਂ ਅਤੇ ਮੇਰੇ ਕੋਲ ਹਰ ਤਰੀਕੇ ਹਰ ਚੀਜ਼ ਹੈਗੀ ਆ ਬਸ ਮੇਰੇ ਕੋਈ ਇੰਟਰਲੋਕ ਮਸ਼ੀਨ ਦੀ ਇੱਕ ਬਸ ਉਹੀ ਚੀਜ਼ ਨਹੀਂ ਹੈ ਇੰਟਰਲੋਕ ਮਸ਼ੀਨ ਚਾਹੀਦੀ ਮੈਨੂੰ ਅਤੇ ਬਸ ਇੰਟਰਲੋਕ ਕਰ ਕੇ ਅਤੇ ਸੂਟ ਦੇ ਦਾ ਹਰ ਤਰ੍ਹਾਂ ਦੇ ਮੈਂ ਸੂਟ ਸਿਲਾਈ ਸਾਰ ਕਰ ਲੈਂਦੀ ਮੇਰਾ ਇੱਕ ਬੁਟੀਕ ਹੈ ਬਹੁਤ ਵੱਡਾ ਤਾਂ ਹਰ ਤਰੀਕੇ ਦੀ ਸਿਲਾਈ ਮੈਂ ਕਰ ਲੈਂਦੀ ਹਾਂ ਅਤੇ ਬਸ ਮੇਰੇ ਕੋਲ ਇੰਟਰਲੋਕ ਵਾਲੀ ਮਸ਼ੀਨ ਬਸ ਮੈਨੂੰ ਉਹ ਚਾਹੀਦੀ ਹੈ ਉਹ ਬਸ ਮਸ਼ੀਨ 'ਤੇ ਇੰਟਰਲੋਕ ਕਰ ਕੇ ਅਤੇ ਮੈਂ ਕੰਪਲੀਟ ਕਰ ਕੇ ਸੂਟ ਉਹਨਾਂ ਨੂੰ ਦੇ ਸਕਾਂ ਠੀਕ ਹੈ ਸਰ